ਜੇ ਮੈਂ ਗੱਲ ਕਰਾਂ ਪੰਜਾਬ ਦੇ ਇਤਿਹਾਸਿਕ ਚੀਜ਼ ਬਾਰੇ ਜਾਂ ਤੁਹਾਨੂੰ ਮੈਂ ਦੱਸਾਂ ਤਾਂ ਇਤਿਹਾਸਿਕ ਕਹਿ ਸਕਦੇ ਇਤਿਹਾਸਿਕ ਭੂਮੀ ਕੀ ਹੈਗੀ ਆ ਗੁਰਦੁਆਰਾ ਹਰਮਿੰਦਰ ਸਾਹਿਬ ਸੱਚਖੰਡ ਹਰਮਿੰਦਰ ਸਾਹਿਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਇਤਿਹਾਸਿਕ ਆ ਕਿਉਂਕਿ ਕੋਈ ਵੀ ਇਹੋ ਜਿਹਾ ਆਈ ਥਿੰਕ ਪਰਸਨ ਨਹੀਂ ਹੋਊਗਾ ਜਿਹਨੂੰ ਇਸ ਬਾਰੇ ਨਹੀਂ ਪਤਾ ਹੋਊਗਾ ਕਿ ਹਰ ਹਰਮਿੰਦਰ ਸਾਹਿਬ ਹੈਗਾ ਵਾ ਉਹ ਅੰਮ੍ਰਿਤਸਰ ਵਿੱਚ ਸਥਾਪਿਤ ਹੈਗਾ ਵਾ ਰਾਮਦਾਸ ਜੀ ਗੁਰ ਰਾਮਦਾਸ ਜੀ ਗੁਰੂ ਜੀ ਦਾ ਵਾ ਗੁਰਦੁਆਰਾ ਵਾ ਅਤੇ ਪਹਿਲਾਂ ਅੰਮ੍ਰਿਤਸਰ ਦਾ ਜਿਹੜਾ ਨਾਮ ਹੈਗਾ ਵਾ ਉਹ ਰਾਮਦਾਸਪੁਰ ਸੀ ਅਤੇ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਗੁਰਦੁਆਰਾ ਹੈਗਾ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਚਮਤਕਾਰ ਹੁੰਦੇ ਰਹੇ ਹੈਗੇ ਆ ਇੱਥੇ ਜਿਹੜੇ ਕੋਹੜੀ ਵੀ ਹੈਗੇ ਆ ਉਹ ਵੀ ਠੀਕ ਹੁੰਦੇ ਰਹੇ ਆ ਇੱਥੋਂ ਦਾ ਜਲ ਛੱਕ ਕੇ ਇੱਥੇ ਲੱਖਾਂ ਦੀ ਤਾਦਾਦ 'ਚ ਰੋਜ਼ ਡੇਲੀ ਹੀ ਜਿਹੜੇ ਸ਼ਰਧਾਲੂ ਹੈਗੇ ਆ ਉਹ ਲੰਗਰ ਛਕਣ ਆਉਂਦੇ ਹੈਗੇ ਆ ਲੰਗਰ ਛਕਦੇ ਆ ਪ੍ਰਸ਼ਾਦ ਖਾਂਦੇ ਆ ਅਤੇ ਆਪਣੀ ਜਿਹੜੀ ਹੈਗੀ ਆ ਮਨੋਕਾਮਨਾ ਮੰਗਦੇ ਹੈਗੇ ਆ ਅਤੇ ਜਿਹੜਾ ਇਹ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈਗਾ ਵਾ ਅਤੇ ਇਹਦੇ ਵਿੱਚ ਸਥਾਪਿਤ ਹੈਗਾ ਹਰਮਿੰਦਰ ਸਾਹਿਬ ਅਤੇ ਹਰ ਕੋਈ ਇਸਦੀ ਆਰਾਮ ਨਾਲ ਖੋਜ ਕਰ ਸਕਦਾ ਵਾ ਕਿਉਂਕਿ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈਗਾ ਵਾ ਅਤੇ ਇਹਦਾ ਜਿਹੜਾ ਗੁਰਬਾਣੀ ਹੈਗੀ ਆ ਹਰਮਿੰਦਰ ਸਾਹਿਬ ਦੀ ਇਹ ਦੂਰ ਦੂਰ ਦੇਸ਼ ਵਿਦੇਸ਼ਾ ਵਿੱਚ ਚੱਲਦੀ ਹੈਗੀ ਆ ਅਤੇ ਸਭ ਇੱਦਾਂ ਦੀ ਬਾਣੀ ਸੁਣਦੇ ਹੈਗੇ ਆ ਕਿਉਂਕਿ ਜਿਹੜੇ ਵਾਹਿਗੁਰੂ ਜੀ ਹੈਗੇ ਆ ਉਹ ਸਭ ਦੀਆਂ ਸੁਣਦੇ ਆ ਦੈਨ ਇਹ ਗੁਰਦੁਆਰਾ ਕੀ ਆ ਬਹੁਤ ਜ਼ਿਆਦਾ ਹੀ ਪ੍ਰਸਿੱਧ ਵਾ ਇੱਥੋਂ ਕਿ ਆ ਆਪਣੇ ਜਿਹੜੇ ਵੱਡੇ ਵੱਡੇ ਜਿਹੜੇ ਆਪਣੇ ਕਹਿ ਸਕਦੇ ਕਿ ਆਪਣੇ ਲੋਕ ਹੈਗੇ ਆ ਉਹ ਵੀ ਹੁੰਦੇ ਆ ਬਾਹਰਲੇ ਦੇਸ਼ਾਂ ਤੋਂ ਆ ਕੇ ਲੋਕ ਇੱਥੇ ਜਿਹੜੇ ਹੈਗੇ ਆ ਆਪਣੀ ਸ਼ਰਧਾ ਅਨੁਸਾਰ ਚੜ੍ਹਾਵਾ ਚੜ੍ਹਾ ਕੇ ਜਾਂਦੇ ਹੈਗੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ ਸੀ ਕਿ ਸੋਨੇ ਦਾ ਪੱਤਰ ਚੜ੍ਹਾਇਆ ਸੀ ਹਰਮਿੰਦਰ ਸਾਹਿਬ ਦੇ ਉੱਪਰ ਅਤੇ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਵਾਕ ਪੜ੍ਹਿਆ ਸੀ ਹਰਮਿੰਦਰ ਸਾਹਿਬ ਵਿੱਚ ਅਤੇ ਬਹੁਤ ਹੀ ਜ਼ਿਆਦਾ ਇਹ ਕੀ ਕਹਿ ਸਕਦੇ ਹਾਂ ਕਿ ਆਪਾਂ ਮਨੋਕਾਮਨਾ ਪੂਰੀਆਂ ਕਰਦਾ ਹੈਗਾ ਗੁਰਦੁਆਰਾ ਅਤੇ ਇੱਕ ਇਤਿਹਾਸਿਕ ਕੀ ਆ ਆਪਣਾ ਗੁਰਦੁਆਰਾ ਹੈਗਾ ਵਾ